ਜ਼ਿੰਦਗੀ ਵਿੱਚ ਕਲਾ ਦੀ ਅਹਿਮੀਅਤ ਕਿਉਂ ਹੈ ਮੈਂ ਕਹਿਣਾ ਚਾਹੁਣ ਜ਼ਿੰਦਗੀ ਵੀ ਇੱਕ ਕਲਾ ਹੈ ਜਿਸ ਪਰਮਾਤਮਾ ਨੇ ਸਾਨੂੰ ਸਿਰਜਿਆ ਹੈ ਉਸਦੀ ਇੱਕ ਕਲਾ ਹੀ ਹੈ ਅਤੇ ਜ਼ਿੰਦਗੀ ਵਿੱਚ ਕਲਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਲਾ ਕਲਾ ਸਾਨੂੰ ਨਿਪੁੰਨਤਾ ਮਾਹਰ ਬਣਾਉਂਦੀ ਹੈ ਕਲਾ ਸਾਡੇ ਅੰਦਰ ਇੱਕ ਨਵੀਂ ਊਰਜਾ ਪੈਦਾ ਕਰਦੀ ਹੈ ਜਦੋਂ ਸਾਡੇ ਕੋਲ ਵੱਖ ਵੱਖ ਤਰ੍ਹਾਂ ਦੀਆਂ ਕਲਾਵਾਂ ਹੁੰਦੀਆਂ ਹਨ ਅਸੀਂ ਕਿਸੇ ਵੀ ਕਸਬ 'ਚ ਮਾਹਰ ਹੁੰਦੇ ਹਾਂ ਅਤੇ ਅਸੀਂ ਕਿਤੇ ਵੀ ਮਾਰ ਨਹੀਂ ਖਾਂਦੇ ਉਹ ਭਾਵੇਂ ਸਾਡੀ ਲਿਖਣ ਕਲਾ ਹੋਵੇ ਉਹ ਭਾਵੇਂ ਸਾਡੀ ਹੋਰ ਕਿਸੇ ਵੀ ਕੰਮ ਕਰਨ ਨੂੰ ਕਲਾ ਹੋਵੇ ਕਲਾ ਦਾ ਜ਼ਿੰਦਗੀ ਵਿੱਚ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ ਕਲਾ ਹੋਵੇਗੀ ਸਾਨੂੰ ਰੁਜ਼ਗਾਰ ਦੀ ਭਾਲ ਨੀ ਰੁਜ਼ਗਾਰ ਸਾਡੇ ਕੋਲ ਆਵੇਗਾ ਕਿਉਂਕਿ ਸਾਡੇ ਕੋਲ ਕਲਾ ਹੈ ਕਲਾ ਹੋਵੇਗੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਲੋਕ ਸਾਡੇ ਕੋਲ ਆਉਣਗੇ ਸਾਡੇ ਕੋਲ ਕਲਾ ਹੋਵੇਗੀ ਤਾਂ ਕਲਾ ਹੋਵੇਗੀ ਅਸੀਂ ਕਿਸੇ ਵੀ ਕੰਮ ਨੂੰ ਆਸਾਨੀ ਨਾਲ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਕੰਮ ਕਰਨ ਦੀ ਕਲਾ ਹੈ ਇਸੇ ਤਰ੍ਹਾਂ ਹੀ ਅਗਰ ਸਾਡੇ ਕੋਲ ਕਲਾ ਹੈ ਤਾਂ ਅਸੀਂ ਜ਼ਿੰਦਗੀ ਦੀ ਕਿਸੇ ਹਿੱਸੇ ਵਿੱਚ ਮਾਰ ਨਹੀਂ ਖਾਵਾਂਗੇ ਕਲਾ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦੀ ਹੈ ਇਸ ਲਈ ਕਲਾ ਦਾ ਜ਼ਿੰਦਗੀ ਵਿੱਚ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ